ਹਾਂਜੀ ਬਚਪਨ ਤੋਂ ਹੀ ਮੈਨੂੰ ਡਰਾਇੰਗ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ ਅਤੇ ਮੈਂ ਇਸ ਕੰਮ ਨੂੰ ਆਪਦੇ ਨੂੰ ਚਾਲੂ ਕਰਨਾ ਚਾਹੁੰਦੀ ਸੀ ਛੇਵੀਂ ਕਲਾਸ 'ਚ ਜਾ ਕੇ ਮੈਂ ਡਰਾਇੰਗ ਕੀਤੀ ਉੱਥੇ ਮੈਂ ਕੰਪੀਟੀਸ਼ਨ ਵੀ ਜਿੱਤਿਆ ਸਾਡੇ ਸਕੂਲ ਦੇ ਵਿੱਚ ਕੰਪੀਟੀਸ਼ਨ ਵੀ ਹੋਇਆ ਸੀਗਾ ਸੀਨਰੀਆਂ ਦਾ ਸੀਨਰੀ ਵਿੱਚ ਮੈਂ ਪ੍ਰਾਈਜ ਲਿਆ ਸੀਗਾ ਮੇਰੀ ਸੀਨਰੀ ਸਭ ਜੱਜਿਸ ਨੂੰ ਬਹੁਤ ਪਸੰਦ ਆਈ ਸੀਗੀ ਅਤੇ ਉਹਨਾਂ ਨੇ ਮੈਨੂੰ ਪ੍ਰਾਈਜ ਵੀ ਦਿੱਤਾ ਸੀਗਾ ਉਹ ਉਹ ਬਹੁਤ ਵਧੀਆ ਸਮਾਂ ਸੀ ਅਤੇ ਉਹ ਮੈਨੂੰ ਅੱਜ ਵੀ ਯਾਦ ਹੈ ਉਹ ਸੀਨਰੀ ਅਤੇ ਮੈਂ ਆਪਦਾ ਇਹ ਜਿਹੜਾ ਕੰਮ ਅੱਗੇ ਵੀ ਚੱਲਣ ਮੈਂ ਅੱਠਵੀਂ ਤੱਕ ਕੀਤੀ ਸੀ ਡਰਾਇੰਗ ਅਤੇ ਇਸ ਤੋਂ ਬਾਅਦ ਵੀ ਮੈਂ ਕਰਨਾ ਚਾਹੁੰਦੀ ਸੀ ਪਰ ਟੀਚਰਸ ਨਾ ਹੋਣ ਕਰਕੇ ਮੈਨੂੰ ਇਹ ਆਪਦਾ ਸ਼ੌਕ ਅਧੂਰਾ ਛੱਡਣਾ ਪਿਆ ਅਤੇ ਮੈਨੂੰ ਡਰਾਇੰਗ ਦੇ ਵਿੱਚ ਬਹੁਤ ਇੰਟਰਸਟ ਹੈਗਾ ਮੈਨੂੰ ਬਹੁਤ ਵਧੀਆ ਲੱਗਦਾ ਸੀ ਡਰਾਇੰਗ ਕਰਨਾ ਕਲਰ ਫਿੱਲ ਕਰਨਾ ਸੀਨਰੀਆਂ ਤਿਆਰ ਕਰਨਾ ਅਤੇ ਸਾਡੇ ਟੀਚਰ ਵੀ ਜੋ ਬਹੁਤ ਵਧੀਆ ਸੀਗੇ ਜਿਹੜੇ ਸਾਨੂੰ ਛੇਵੀਂ ਤੋਂ ਅੱਠਵੀਂ ਤੱਕ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ ਸੀਗਾ ਅਤੇ ਉਹ ਸਾ ਬਹੁਤ ਵਧੀਆ ਸਾਨੂੰ ਇੰਟਰਸ ਨਾਲ ਪੜ੍ਹਾਉਂਦੇ ਸੀਗੇ ਸਾਡਾ ਜਿਹੜਾ ਅੰਦਰੂਨੀ ਰੂਹ ਸੀਗੀ ਉਹ ਵੀ ਸਾਡੀ ਖੁਸ਼ ਹੋ ਜਾਂਦੀ ਸੀਗੀ ਜਦੋਂ ਸਾਨੂੰ ਉਹ ਡਰਾਇੰਗ ਕਰਵਾਉਂਦੇ ਸੀਗੇ ਅਤੇ ਮੈਨੂੰ ਵਧੀਆ ਲੱਗਦਾ ਸੀਗਾ ਅਤੇ ਮੈਂ ਬਹੁਤ ਪਸੰਦ ਕਰਦੀ ਹਾਂ ਇਸ ਚੀਜ਼ ਨੂੰ